ਹੈਲੋ ਹਾਂਜੀ ਕੋਣ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਇੱਥੇ ਅੱਜ ਕੱਲ੍ਹ ਵਾ ਕਾਫ਼ੀ ਵਹਿਮ ਭਰਮ ਚੱਲੇ ਹੋਏ ਆ ਅਤੇ ਲੋਕ ਕਈ ਪ੍ਰਕਾਰ ਦੇ ਵਹਿਮ ਕਰਦੇ ਜਿਵੇਂ ਕਿ ਆਪਾਂ ਆਮ ਹੀ ਸੁਣ ਲੈਂਦੇ ਹਾਂ ਬਿੱਲੀ ਰਸਤਾ ਕੱਟ ਗਈ ਤਾਂ ਫਿਰ ਅੱਗੇ ਜਾਣਾ ਮਾੜਾ ਮੰਨਦੇ ਅਤੇ ਵਾਪਿਸ ਮੁੜ ਜਾਂਦੇ ਆ ਜਾਂ ਪਿੱਛੋਂ ਆਵਾਜ਼ ਮਾਰਲੇ ਬੰਦਾ ਤਾਂ ਫਿਰ ਉਹਨੂੰ ਵਹਿਮ ਭਰਮ ਨੂੰ ਕਾਫ਼ੀ ਮੰਨਦੇ ਆ ਲੋਕ ਕਿ ਮੰਗਲਵਾਰ ਨੂੰ ਸਿਰ ਨਹੀਂ ਨਹਾਉਣਾ ਚਾਹੀਦਾ ਵਗੈਰਾ ਅਤੇ ਉਸ ਉਸ ਤੋਂ ਇਲਾਵਾ ਕਾਫ਼ੀ ਮੜੀਆਂ ਵਗੈਰਾ ਦੀ ਪੂਜਾ ਕਰਦੇ ਹੈ ਅਤੇ ਉਸ ਤੋਂ ਇਲਾਵਾ ਕਾਫ਼ੀ ਹੈਗੇ ਆ ਮਤਲਬ ਅਤੇ ਜਿਵੇਂ ਕਿ ਲੋਕ ਕਬਰ ਪੁੱਟਦੇ ਆ ਅਤੇ ਉਹਦੇ ਵਿੱਚੋਂ ਮਤਲਬ ਮਿੱਟੀ ਵਗੈਰਾ ਕੱਢਦੇ ਉਹਨਾ ਦਾ ਕੁਛ ਹੁੰਦਾ ਅਤੇ ਇਹੋ ਜਿਹੇ ਵਹਿਮ ਭਰਮ ਕਾਫ਼ੀ ਚੱਲੇ ਹੋਏ ਆ ਹਾਂਜੀ ਅਤੇ ਹਾਂਜੀ ਅੱਜ ਕੱਲ੍ਹ ਦੇ ਜਵਾਕ ਤਾਂ ਨਹੀਂ ਕਰਦੇ ਪਰ ਜਿਹੜੇ ਪਹਿਲਾਂ ਲੋਕ ਆ ਉਹ ਕਾਫ਼ੀ ਕਰਦੇ ਹੁਣ ਤਾਂ ਜਿਵੇਂ ਵਧੀਆ ਹੁੰਦੇ ਆ ਓਵੇਂ ਓਵੇਂ ਘਟੀ ਜਾਂਦਾ ਮਤਲਬ ਵਹਿਮ ਭਰਮ ਹੁਣ ਬਦਲੀ ਬਦਲੀ ਜਾਂਦੇ ਹਾਂਜੀ ਹਾਂਜੀ ਹੁਣ ਤਾਂ ਬਦਲੀ ਜਾਂਦੇ ਜਿਵੇਂ ਜਿਵੇਂ ਹੋਈ ਜਾਂਦਾ ਅਗਲਾ ਸਮਾਂ ਆਉਂਦਾ ਪਿਆ ਓਵੇਂ ਓਵੇਂ ਘਟੀ ਜਾਂਦੇ ਲੋਕ ਓਵੇਂ ਓਵੇਂ ਹਟੀ ਜਾਂਦੇ ਮੰਨਣ ਨੂੰ ਨਹੀਂ ਪਿੰਡਾਂ ਵਗੈਰਾ ਵਾਲੇ ਪਾਸੇ ਥੋੜ੍ਹੇ ਜ਼ਿਆਦਾ ਹੁੰਦੇ ਇੱਧਰ ਥੋੜ੍ਹੇ ਸ਼ਹਿਰ ਵਾਲੇ ਪਾਸੇ ਵੀ ਥੋੜ੍ਹੇ ਘੱਟ ਮੰਨ ਦੇ ਲੋਕ ਬਾਕੀ ਹੋਰ

ਹਾਂਜੀ ਹਾਂਜੀ ਅਸੀਂ ਇਸ ਗੱਲ 'ਤੇ ਚੱਲਦੇ ਹਾਂ ਅੱਜ ਕੱਲ੍ਹ ਵਹਿਮ ਭਰਮ ਘੱਟ ਹੀ ਮੰਨਦੇ ਆ ਸਾਡੇ ਵੀ ਨਹੀਂ ਕਰ ਦਾ ਕੁਛ ਪਰ ਕਈ ਲੋਕ ਹੈਗੇ ਹਾਲੇ ਵੀ ਜਿਹੜੇ ਵਾਹ ਵਾਹ ਕਰਦੇ ਆ ਹੋਰ ਕੁਛ ਨਹੀਂ ਠੀਕ ਹੈ ਜੀ